ਮੈਂ ਇਹ ਚਾਹੁੰਦਾ ਹਾਂ ਕਿ ਤਕਨੋਲਜੀ ਇੱਕ ਹੱਦ ਤੱਕ ਹੋਰ ਹੋਰ ਅੱਗੇ ਵੱਧ ਵਧੇ ਜਿਵੇਂ ਕਿ ਜੀਵਨ ਦੀਆਂ ਆਮ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਅਤੇ ਮਨੁੱਖੀ ਇੰਟਰ ਕਨੈਕਸ਼ਨ ਨੂੰ ਹੋਰ ਪ੍ਰਭਾਵ ਪ੍ਰਭਾਵਸ਼ਾਲੀ ਬਣਾਉਣ 'ਚ ਵਿੱਚ ਅੱਜ ਕੱਲ੍ਹ ਜਦੋਂ ਟੈਕਨੋਲਜੀ ਸਾਡੇ ਜੀਵਨ ਦਾ ਹਿੱਸਾ ਬਣ ਗਏ ਹਨ ਤਾਂ ਕੁਝ ਖਾਸ ਖੇਤਰ ਹਨ ਜਿੱਥੇ ਮੈਂ ਇਸਦੀ ਕੁਝ ਹੋਰ ਖੂਬੀਆਂ ਦੀ ਉਮੀਦ ਕਰਦਾ ਹਾਂ ਪਹਿਲਾਂ ਮੈਂ ਇ ਇੰਟਲ ਇੰਟਲ ਇੰਟੈਲੀਜੈਂਸ ਇੰਟੈਲੀਜੈਂਟ ਸਿਸਟਮ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਹੋਰ ਅੱਗੇ ਵਧਾਉਣ ਦੀ ਸ ਸੋਚਦਾ ਹਾਂ ਜਿਸ ਨਾਲ ਸਾਡੀਆਂ ਚਿ ਦਿਨ ਚਰ ਦਿਨ ਚਰਨਾ ਦੀਆਂ ਗਤੀਵਿਧੀਆਂ ਜਿਵੇਂ ਕਿ ਕੰਮ ਅਤੇ ਅਧਿਐਨ ਅਤੇ ਆਧਿਐਨ ਅਤੇ ਹੋਰ ਰੋਜ਼ਾਨਾ ਕਾਰਜ ਜ਼ਿਆਦਾ ਆਸਾਨ ਅਤੇ ਪ੍ਰਸੰਗਿਕ ਪ੍ਰਸੰਗਿਕ ਹੋ ਸਕਣ ਹੋ ਸਕਣ ਉਦਾਹਰਨ ਜਿਵੇਂ ਉਦਾਹਰਨ ਵਜੋਂ ਇੱਕ ਏ ਆਈ ਚਲਿਤ ਚਲਿਤ ਏ ਆਈ ਚਲਿਤ ਅਧਿਐਨ ਸਹਾਇਕ ਜੋ ਸ ਸਹਾਇਕ ਜੋ ਵਿਦਿਆਰਥੀਆਂ ਨੂੰ ਨਿੱਜੀ ਤੌਰ 'ਤੇ ਸਿੱਖਣ ਲਈ ਟੋਲਸ ਪ੍ਰਦਾਨ ਟੂਲਸ ਪ੍ਰਦਾਨ ਕਰ ਸਕੇ ਅਤੇ ਇਹ ਸਿੱਖਣ ਦੇ ਸੰਪੀ ਸਿੱਖਣ ਦੀ ਸਪੀਡ ਅਤੇ ਪ੍ਰੀ ਪ੍ਰਕਿਰਿਆ ਪ੍ਰੀਖਿਆ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਦੇ ਸਕਦਾ ਹੈ ਦੂਜਾ ਮੈਂ ਇਹ ਵੀ ਚਾਹੁੰਦਾ ਹਾਂ ਕਿ ਤਕਨੋਲਜੀ ਹੋਰ ਬਿਹਤਰ ਤਰੀਕੇ ਨਾਲ ਸਿਹ ਸਹਾਇਕ ਬਣੇ ਧੰਨਵਾਦ